ਸੱਤ ਫਰਵਰੀ ਦੋ ਹਜ਼ਾਰ ਪੰਜ ਵੀਹ ਨਵੰਬਰ ਦੋ ਹਜ਼ਾਰ ਦੋ ਦਸ ਅਪ੍ਰੈਲ ਦੋ ਹਜ਼ਾਰ ਚਾਰ ਚਾਰ ਸਤੰਬਰ ਉੱਨੀ ਸੌ ਸਤਾਨਵੇਂ ਪੰਦਰਾਂ ਸਤੰਬਰ ਦੋ ਹਜ਼ਾਰ ਇੱਕ